ਮੈਂ ਸ਼ੁਰੂ ਤੋਂ ਹੀ ਇੱਕ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ਹੀ ਹਾਂ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਪੜ੍ਹੀ ਹਾਂ ਇਹ ਇੱਕ ਸੀ ਬੀ ਐੱਸ ਈ ਮੀਡੀਅਮ ਸਕੂਲ ਸੀ ਅਤੇ ਇਸ ਵਿੱਚ ਸਾਰੀ ਪੜ੍ਹਾਈ ਅੰਗਰਜ਼ੀ ਮੀਡੀਅਮ ਵਿੱਚ ਹੀ ਹੁੰਦੀ ਰਹੀ ਹੈ ਇਸ ਦੇ ਵਿੱਚ ਮੇਰੇ ਨੰਬਰ ਵੀ ਵਧੀਆ ਆਏ ਅਤੇ ਮੈਂ ਪਾਸ ਵੀ ਬਹੁਤ ਵਧੀਆ ਨੰਬਰਾਂ ਨਾਲ ਹੋਈ ਉਸ ਤੋਂ ਬਾਅਦ ਮੈਂ ਆਪਣੀ ਅੱਗੇ ਦੀ ਪੜ੍ਹਾਈ ਆਪਣੇ ਹੀ ਸ਼ਹਿਰ ਦੇ ਸੰਤ ਕਰਮ ਸਿੰਘ ਅਕੈਡਮੀ ਦੇ ਵਿੱਚ ਕੀਤੀ ਸੀ ਇਸ ਦੇ ਵਿੱਚ ਮੈਂ ਅੱਗੇ ਗਿਆਰਵੀਂ ਅਤੇ ਬਾਰ੍ਹਵੀਂ ਲਈ ਸਬਜੇਕਟ ਚੂਜ਼ ਕਰਨੇ ਸੀ ਉਸ ਦੇ ਵਿੱਚ ਮੈਂ ਚੂਜ਼ ਕੀਤਾ ਫਿਜਿਕਸ ਕੇਮਿਸਟਰੀ ਮੈਥ ਦੇ ਨਾਲ ਨਾਲ ਮੈਂ ਫਿਜ਼ੀਕਲ ਐਜੂਕੇਸ਼ਨ ਅਤੇ ਅੰਗਰੇਜ਼ੀ ਦੀ ਅੰਗਰੇਜ਼ੀ ਦਾ ਚੌਣ ਕੀਤਾ ਇਸ ਦੇ ਵਿੱਚ ਵੀ ਮੈਂ ਦੋਜ ਇਸ ਸਕੂਲ ਦੇ ਵਿੱਚ ਮੈਂ ਦੋ ਸਾਲ ਪੜ੍ਹਾਈ ਕੀਤੀ ਗਿਆਰਵੀਂ ਅਤੇ ਬਾਰ੍ਹਵੀਂ ਇਸ ਦੇ ਵਿੱਚ ਮੈਂ ਦੋ ਸਾਲ ਹੀ ਫਿਜਿਕਸ ਕੇਮਿਸਟਰੀ ਮੈਥ ਅੰਗਰੇਜ਼ੀ ਅਤੇ ਫਿਜ਼ੀਕਲ ਐਜੂਕੇਸ਼ਨ ਪੜ੍ਹਿਆ ਹੈ ਜਿਸ ਦੇ ਵਿੱਚ ਮੇਰੇ ਕਾਫ਼ੀ ਵਧੀਆ ਨੰਬਰ ਆਏ ਅਤੇ ਮੇਰੇ ਘਰਦਿਆਂ ਨੂੰ ਵੀ ਮੇਰੇ 'ਤੇ ਮਾਣ ਹੈ ਉਸ ਤੋਂ ਬਆਦ ਮੈਂ ਅੱਗੇ ਗ੍ਰੈਜੂਏਸ਼ਨ ਕਰਨ ਲਈ ਕਾਫੀ ਸਾਰੇ ਕੌਲੇਜ ਦੇਖੇ ਅਤੇ ਉਸ ਤੋਂ ਬਆਦ ਮੈਂ ਚੌਣ ਕੀਤਾ ਆਪਣੇ ਨੇ ਨੇੜੇ ਹੀ ਇੱਕ ਕੌਲਜ ਜਿਹੜਾ ਕਿ ਬਹੁਤ ਵੱਡਾ ਹੈ ਇਹ ਇੱਕ ਯੂਨੀਵਰਸਿਟੀ ਹੈ ਅਤੇ ਇਸ ਦੇ ਵਿੱਚ ਵੀ ਇੰਗਲਿਸ਼ ਮੀਡੀਅਮ ਪੜ੍ਹਾਈ ਹੀ ਹੁੰਦੀ ਹੈ ਇਹ ਕੌਲਜ ਦੇ ਵਿੱਚ ਮੈਂ ਬੀ ਐੱਸਈ ਐਨੀਮੇਸ਼ਨ ਵੀ ਐੱਫ ਐਕਸ ਅਤੇ ਗੇਮਿੰਗ ਕੀਤਾ ਹੈ ਇਹ ਅੱਜ ਕੱਲ੍ਹ ਦੀ ਕਾਫ਼ੀ ਵੱਡੀ ਆਉਣ ਵਾਲੀ ਜਨਰੇਸ਼ਨ ਹੈ ਜਿਸ ਨੂੰ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਹੀ ਸਨਮਾਨਿਤ ਅਤੇ ਪ੍ਰਯੋਗ ਕਰਦੇ ਹਨ ਅੱਜ ਕੱਲ੍ਹ ਹਰੇਕ ਨੂੰ ਗੇਮ ਬਣਾਉਣ ਦਾ ਅਤੇ ਐਨੀਮੇਸ਼ਨ ਅਤੇ ਕਾਰਟੂਨ ਦੇਖਣੇ ਦਾ ਬਹੁਤ ਸ਼ੌਕ ਚੜ੍ਹਿਆ ਹੈ ਇਸ ਦੇ ਲਈ ਲੋਕ ਅੱਜ ਕੱਲ੍ਹ ਕਾਫੀ ਸਾਰੇ ਯੂਟਿਊਬ ਚੈੱਨਲ ਵੀ ਖੋਲ੍ਹਦੇ ਹਨ ਆਪਣੇ ਗੇਮ ਸਕਿੱਲ ਨੂੰ ਪ੍ਰੋਮੋਟ ਕਰਨ ਲਈ ਅਤੇ ਇਸ ਦੇ ਵਿੱਚ ਮੈਂ ਤਿੰਨ ਸਾਲ ਦੀ ਡਿਗਰੀ ਕੀਤੀ ਹੈ ਅਤੇ ਮੈਂ ਅੰਤ ਵਿੱਚ ਇੱਕ ਨੌਕਰੀ ਪ੍ਰਾਪਤ ਕੀਤੀ ਜਿਹੜੀ ਕਿ ਮੈਨੂੰ ਇਸੇ ਫ਼ੀਲਡ ਦੇ ਵਿੱਚ ਮਿਲੀ ਸੀ